ਉੱਨੀ ਅਕਤੂਬਰ ਦੋ ਹਜ਼ਾਰ ਚਾਰ ਛੇ ਜਨਵਰੀ ਦੋ ਹਜ਼ਾਰ ਪੰਜ ਵੀਹ ਦਸੰਬਰ ਦੋ ਹਜ਼ਾਰ ਇੱਕ ਚੌਦਾਂ ਦਸੰਬਰ ਦੋ ਹਜ਼ਾਰ ਦੋ ਤੇਈ ਸਤੰਬਰ ਦੋ ਹਜ਼ਾਰ ਸਤਾਰਾਂ